ਪੰਜਾਬ ਦੇ ਰਿਵਾਇਤੀ ਕੱਪੜੇ ਅਤੇ ਫੈਸ਼ਨ ਇਹ ਹਨ ਕਿ ਲੇਡੀ ਜਿਹੜੀਆਂ ਨੇ ਉਹ ਜ਼ਿਆਦਾਤਰ ਸਲਵਾਰ ਕਮੀਜ਼ ਪਾਉਣਾ ਪਸੰਦ ਕਰਦੀਆਂ ਹਨ ਅਤੇ ਪੰਜਾਬੀ ਜੁੱਤੀ ਪਾਉਣਾ ਪਸੰਦ ਕਰਦੀਆਂ ਹਨ ਅਤੇ ਬੰਦੇ ਚਾਦਰਾ ਅਤੇ ਕਮੀਜ਼ ਕੁੜਤਾ ਅਤੇ ਤੁਰਲੇ ਵਾਲੀ ਪੱਗ ਅਤੇ ਪੰਜਾਬੀ ਜੁੱਤੀ ਪਾਉਣਾ ਪਸੰਦ ਕਰਦੇ ਹਨ ਇਹ ਤੁਸੀਂ ਆਮ ਹੀ ਕੋਈ ਫੈਸਟੀਵਲ 'ਤੇ ਉਹਨਾਂ ਨੂੰ ਇਹ ਪਾਇਆ ਹੋਇਆ ਵੇਖ ਸਕਦੇ ਹਾਂ ਅਤੇ ਰੂਟੀਨ ਦੇ ਵਿੱਚ ਜੇ ਵੇਖਿਆ ਜਾਵੇ ਤਾਂ ਰੂਟੀਨ ਦੇ ਵਿੱਚ ਪਟਿਆਲਾ ਸ਼ਾਹੀ ਪੱਗ ਅਤੇ ਲੇਡੀਜ਼ ਵਾਸਤੇ ਸਲਵਾਰ ਅਤੇ ਕੁੜਤਾ ਨਾਲ਼ ਦੁਪੱਟਾ ਪੰਜਾਬੀ ਜੁੱਤੀ ਇਹ ਚੀਜ਼ ਉਹਨਾਂ 'ਤੇ ਬਹੁਤ ਹੀ ਜ਼ਿਆਦਾ ਫੱਬਦਾ ਹੈ